ਬੈਂਕਾਂ ਨੇ ਨਾਗਰਿਕਾਂ ਦੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ ਪਹਿਲਾਂ ਜੋ ਯੋਜਨਾਵਾਂ ਸਿਰਫ਼ ਬਾਹਰ ਮਿਲਦੀਆਂ ਸੀ ਹੁਣ ਸਾਨੂੰ ਆਪਣੇ ਪੰਜਾਬ ਆਪਣੇ ਭਾਰਤ 'ਚ ਰਹਿ ਕੇ ਸਭ ਯੋਜਨਾਵਾਂ ਦਾ ਲਾਭ ਉਠਾਉਣ ਨੂੰ ਮਿਲਦਾ ਹੈ ਕੁਛ ਚੀਜ਼ਾਂ ਜੋ ਬੱਚਿਆਂ ਨੇ ਕਦੀ ਜਾਂ ਅਸੀਂ ਲੋਕਾਂ ਨੇ ਕਦੀ ਸੋਚੀਆ ਨਹੀਂ ਸੀ ਹੁਣ ਉਹ ਹਰ ਥਾਂ ਬੜੇ ਆਰਾਮ ਨਾਲ ਸਾਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਕਿਸੇ ਤਰ੍ਹਾਂ ਦੀ ਬੁਢਾਪੇ ਲਈ ਯੋਜਨਾ ਹੋਵੇ ਕਿਸੇ ਆਪਣੇ ਬੱਚੇ ਨੂੰ ਪੜ੍ਹਾਉਣਾ ਹੋਵੇ ਹੁਣ ਬੈਂਕਾਂ ਨੇ ਸਾਡੇ ਲਈ ਸਭ ਕੁਝ ਬਹੁਤ ਆਸਾਨ ਬਣਾ ਦਿੱਤਾ ਹੈ ਪੈਸੇ ਦਾ ਲੈਣ ਦੇਣ ਹੋਰ ਵੀ ਸੌਖਾ ਕਰ ਦਿੱਤਾ ਹੈ ਇਹਨਾਂ ਯੋਜਨਾਵਾਂ ਦੇ ਰਹਿਤ ਇਨਸਾਨ ਆਪਣੇ ਬੁਢਾਪੇ ਬਾਰੇ ਪਹਿਲਾਂ ਹੀ ਸੋਚ ਸਕਦਾ ਹੈ ਆਪਣੇ ਇਲਾਜ ਬਾਰੇ ਬਹੁਤ ਅੱਛੇ ਤਰ੍ਹਾਂ ਸੋਚ ਸਕਦਾ ਹੈ ਰਿਟਾਇਰਮੈਂਟ ਸਕੀਮਾਂ ਨੇ ਸਾਨੂੰ ਬਾਹਰ ਜਾਣ ਤੋਂ ਸਾਡੇ ਦੇਸ਼ ਤੋਂ ਬੱਚੇ ਜਿਹੜੇ ਇਥੋਂ ਜਾ ਰਹੇ ਸੀਗੇ ਬਾਹਰ ਪੜ੍ਹਨ ਲਈ ਉਹਨਾਂ ਨੂੰ ਰੋਕ ਦਿੱਤਾ ਹੈ ਜੋ ਚੀਜ਼ਾਂ ਨੂੰ ਅਸੀਂ ਇਨਸਾਨ ਬਾਹਰ ਲੱਭ ਰਹੇ ਸੀ ਬਾਹਰ ਭੱਜ ਰਹੇ ਸੀ ਜਦ ਸਾਡੀ ਸਰਕਾਰ ਨੇ ਸਾਨੂੰ ਸਾਡੇ ਆਪਣੇ ਦੇਸ਼ 'ਚ ਹੀ ਦੇ ਦਿੱਤੀਆਂ ਹਨ ਬੈਂਕ ਅਤੇ ਬੀਮਾ ਰਿਟਾਇਰਮੈਂਟ ਅਤੇ ਬੀਮਾ ਕੰਪਨੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਦਿੱਤਾ ਹੈ ਅਸੀਂ ਇਹਨਾਂ ਦੇ ਰਾਹੀਂ ਆਪਣੇ ਖਾਤੇ ਖੁਲਵਾ ਕੇ ਆਪਣੇ ਸਾਰੇ ਪੈਸੇ ਨੂੰ ਇੱਥੇ ਜਮ੍ਹਾਂ ਕਰਵਾ ਕੇ ਵਧਾਉਣ ਦੇ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਪੂਰੇ ਖਾਬ ਦੇਖ ਸਕਦੇ ਹਾਂ